ਹਾਂਜੀ ਤਰਨਤਾਰਨ ਜਿਲ੍ਹੇ ਵਿੱਚ ਜੇ ਗੱਲ ਕਰੀਏ ਸਿਹਤ ਸੰਭਾਲ ਪ੍ਰਣਾਲੀ ਦੀ ਤਾਂ ਕਾਫ਼ੀ ਹੱਦ ਤੱਕ ਬਹੁਤ ਵਧੀਆ ਕਿਉਂਕਿ ਜ਼ਿਲ੍ਹਾ ਬਣਨ ਦੇ ਨਾਲ ਇੱਥੇ ਕਾਫ਼ੀ ਡਿਵੈਲਪਮੈਂਟ ਆਈ ਹੈ ਜਿਵੇਂ ਸਾਡੇ ਸਰਕਾਰੀ ਹੋਸਪੀਟਲ ਸੀਗਾ ਪਹਿਲਾਂ ਤਾਂ ਉਹਦੀ ਐਡੀ ਕੋਈ ਵਧੀਆ ਹਾਲਤ ਨਹੀਂ ਸੀਗੀ ਪਰ ਹੌਲੀ ਹੌਲੀ ਜਦੋਂ ਇੱਧਰ ਧਿਆਨ ਦਿੱਤਾ ਗਿਆ ਤਾਂ ਹੁਣ ਕਾਫ਼ੀ ਉੱਥੇ ਮਤਲਬ ਹੈਗੀਆਂ ਨੇ ਫੈਸਿਲਿਟੀਜ਼ ਬੜੀ ਦੂਰੋਂ ਦੂਰੋਂ ਲੋਕ ਜਿਹੜੇ ਆਉਂਦੇ ਨੇ ਕਿਉਂਕਿ ਇਹਦਾ ਇੱਕ ਹੋਰ ਵੀ ਕਾਰਨ ਹੈ ਕਿ ਇੰਨਾ ਮਹਿੰਗਾ ਨਹੀਂ ਹੈ ਪਹਿਲਾਂ ਇੱਥੇ ਜ਼ਰੂਰੀ ਸੀਗਾ ਵੀ ਨਹੀਂ ਸੀ ਧਿਆਨ ਦਿੱਤਾ ਜਾਂਦਾ ਪੇਸ਼ੈਂਟ ਵੱਲ ਪਰ ਜਦੋਂ ਲੋਕਾਂ ਨੇ ਇਸ ਸਬੰਧੀ ਆਵਾਜ਼ ਚੁੱਕੀ ਸਰਕਾਰ ਤੱਕ ਜਾਂ ਕਿਸੇ ਵੀ ਅਹੁਦੇ 'ਤੇ ਜਿਹੜੇ ਬੈਠੇ ਨੇ ਬੰਦੇ ਉਹਨਾਂ ਤੱਕ ਗੱਲ ਗਈ ਤਾਂ ਉਹਨਾਂ ਨੇ ਇਸ ਵੱਲ ਪੂਰਾ ਧਿਆਨ ਦਿੱਤਾ ਅਤੇ ਸੋ ਇਹ ਇੱਕ ਮੇਨ ਥੰਮ ਹੈ ਸਾਡੇ ਇਲਾਕੇ ਦਾ ਕਿ ਤਰਨਤਾਰਨ ਜਿਲ੍ਹਾ ਜਿਹੜਾ ਆ ਪਿੰਡ ਨਾਲ ਬਹੁਤ ਲੱਗਦੇ ਨੇ ਅੰਮ੍ਰਿਤਸਰ ਜਾਣਾ ਉਹਨਾਂ ਨੂੰ ਬੜੀ ਦੂਰ ਲੱਗਦਾ ਹੈ ਇਸ ਕਰਕੇ ਉਹ ਜ਼ਿਆਦਾ ਮਤਲਵ ਸਿਵਲ ਹੋਸਪਿਟਲ ਜਿਹੜਾ ਸਾਡਾ ਆ ਉੱਧਰ ਨੂੰ ਜ਼ਿਆਦਾ ਧਿਆਨ ਕਰਦੇ ਨੇ ਇੱਕ ਤਾਂ ਟਾਈਮ ਘੱਟ ਹੈ ਦੂਜੀ ਇੱਥੇ ਫੈਸਿਲਿਟੀ ਬੜੀਆਂ ਅੱਛੀਆਂ ਆਈਆਂ ਨੇ ਡਾਕਟਰ ਅੱਛੇ ਨੇ ਸੋ ਬੜਾ ਧਿਆਨ ਦੇ ਨਾਲ ਉਹ ਕੇਸ ਜਿਹੜੇ ਆ ਉਹ ਇਹਨਾਂ ਨੂੰ ਮਤਲਬ ਦੇਖਦੇ ਨੇ ਜਾਂਚ ਕਰਦੇ ਨੇ ਡੋਕਟਰ ਪਹਿਲਾਂ ਕਾਫ਼ੀ ਹੱਦ ਤੱਕ ਸੀਗੇ ਜੋ ਨਜ਼ਰ ਅੰਦਾਜ਼ ਕਰਦੇ ਸੀ ਆਪਣੀ ਡਿਊਟੀਆਂ ਪ੍ਰਤੀ ਨਹੀਂ ਸੀ ਅਵੇਅਰ ਹੈਗੇ ਬਟ ਹੌਲੀ ਹੌਲੀ ਦੇਖਦਿਆਂ ਉਹਦੀ ਬਿਲਡਿੰਗ ਇਮਾਰਤ ਵਿੱਚ ਵੀ ਕਾਫ਼ੀ ਫ਼ਰਕ ਪਿਆ ਅਤੇ ਲੋਕਾਂ ਨੇ ਜਦੋਂ ਇੱਧਰ ਨੂੰ ਮਤਲਬ ਆਉਣਾ ਸ਼ੁਰੂ ਕੀਤਾ ਹੈ ਤਾਂ ਕਾਫ਼ੀ ਹੱਦ ਤੱਕ ਅਸੀਂ ਕਹਿ ਸਕਦੇ ਹਾਂ ਕਿ ਤਰਨਤਾਰਨ ਜਿਲ੍ਹੇ ਵਿੱਚ ਜਿਹੜੀ ਇਹ ਸਿਹਤ ਸੰਭਾਲ ਪ੍ਰਣਾਲੀ ਹੈ ਜਾਂ ਹੋਰ ਵੀ ਕਈ ਛੋਟੇ ਮੋਟੇ ਹੋਸਪਿਟਲ ਨੇ ਉਹ ਵੀ ਬਹੁਤ ਅੱਛੇ ਨੇ ਅਤੇ ਇਸ ਪ੍ਰਤੀ ਸਾਡਾ ਪੋਜੀਟਿਵ ਹੀ ਹੈਗੀ ਔਪੀਨੀਅਨ ਕਿ ਬਹੁਤ ਅੱਛਾ ਆ ਡੋਕਟਰ ਵੀ ਬਹੁਤ ਅੱਛੇ ਨੇ ਸੋ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਵੀ ਜਾਂ ਉਹਨਾਂ ਲੋਕਾਂ ਦਾ ਜਿਹਨਾਂ ਨੇ ਇਹਨਾਂ ਦੇ ਖਿਲਾਫ ਆਵਾਜ਼ ਚੁੱਕੀ ਹੈ ਸੋ ਅੱਛੀ ਸਾਨੂੰ ਇਥੋਂ ਮਿਲਦੀ ਹੈ ਮਤਲਬ ਸਿਹਤ ਸਹੂਲਤ ਜਿਹੜੀ ਹੈ ਬਹੁਤ ਅੱਛੀ ਹੈ ਇਹਨਾਂ ਦੀ ਥੈਂਕ ਯੂ